ਅਸੀਂ ਅੰਬ ਕੀਨੂੰ ਮਸੰਮੀ ਮਾਲਟਾ ਅਤੇ ਹੋਰ ਕਈ ਤਰ੍ਹਾਂ ਦੇ ਬੂਟੇ ਲਗਾਏ ਹੋਏ ਨੇ ਇਹਨਾਂ ਵਿੱਚ ਮਤਲਬ ਅਸੀਂ ਦੇਸੀ ਖਾਦ ਪਾ ਕੇ ਕਲੀ ਵਗੈਰਾ ਵੀ ਪਾਉਂਦੇ ਹਾਂ ਇਹਨਾਂ ਦੀ ਫੁੱਲ ਅਸੀਂ ਕੇਅਰ ਕਰਦੇ ਹਾਂ ਇਸ ਤੋਂ ਬਿਨਾਂ ਅਸੀਂ ਨਿੰਬੂ ਵੀ ਲਗਾਏ ਹੋਏ ਨੇ ਜਿਹੜੇ ਕਿ ਵਧੀਆ ਸਿਕੰਜਮੀ ਲਈ ਅਸੀਂ ਤਿਆਰ ਕਰ ਲਈ ਬੀਜੇ ਹੋਏ ਨੇ ਬਾਕੀ ਜਿਹੜੀਆਂ ਬੇਲਾਂ ਨੇ ਅਸੀਂ ਕੱਦੂ ਦੀਆਂ ਰਾਮਤੋਰੀ ਦੀਆਂ ਲਗਾਉਂਦੇ ਹਾਂ ਉਹ ਗਰਮੀਆਂ ਵਿੱਚ ਲੱਗਦੀਆਂ ਨੇ ਜ਼ਿਆਦਾਤਰ ਅਤੇ ਸਰਦੀਆਂ ਵਿੱਚ ਮੂਲੀਆਂ ਵਗੈਰਾ ਵੱਟਾਂ 'ਤੇ ਲਗਾਈਆਂ ਹੋਈਆਂ ਨੇ ਮੇਥੇ ਬੀਜੇ ਹੋਏ ਨੇ ਨਾਲ ਉਹਦੇ ਨਾਲ ਨਾਲ ਚਿਕੰਦਰ ਸਾਗ ਸਰ੍ਹੋਂ ਦਾ ਪਾਲਕ ਵਗੈਰਾ ਬੀਜੀ ਹੋਈ ਹੈ ਜਿਹੜੇ ਕਿ ਆਪਣੇ ਸਰਦੀਆਂ 'ਚ ਅਸੀਂ ਵਰਤੋਂ ਕਰਦੇ ਹਾਂ ਗੋਭੀ ਦੇ ਬੂਟੇ ਵੀ ਅਸੀਂ ਲਗਾਏ ਹੋਏ ਨੇ ਕਾਫੀ ਸਬਜ਼ੀ ਅਸੀਂ ਜਿਹੜੇ ਕਿ ਬਿਨਾਂ ਸਪਰੇਅ ਤੋਂ ਔਰਗੈਨਿਕ ਤਿਆਰ ਕਰਦੇ ਹਾਂ ਨਾਲ ਨਾਲ ਅਸੀਂ ਵੱਟਾਂ 'ਤੇ ਅੱਜ ਕੱਲ੍ਹ ਹਲਦੀ ਅਰਬੀ ਦੀ ਸਬਜ਼ੀ ਵੀ ਪੈਦਾ ਕਰਦੇ ਹੈ ਬਾਕੀ ਖੇਤੀਬਾੜੀ ਵਿੱਚ ਅਸੀਂ ਆਲੂ ਵਗੈਰਾ ਵੀ ਬੀਜਦੇ ਐਂ ਅਤੇ ਹੁਣ ਅੱਜ ਕੱਲ੍ਹ ਜੋ ਹੁਣ ਸਰਦੀ ਵਿੱਚ ਨਵੰਬਰ ਵਿੱਚ ਕਣਕ ਵਗੈਰਾ ਬੀਜੀ ਹੋਈ ਆ ਅਤੇ ਕਣਕ ਵੱਢਣ ਤੋਂ ਬਾਅਦ ਕਈ ਵਾਰੀ ਮੱਕੀ ਅਤੇ ਜੀਰੀ ਲਗਾਈ ਜਾਂਦੀ ਹੈ ਤਾਂ ਕਰਕੇ ਵੀ ਕਾਫੀ ਫਲਦਾਰ ਦਰਖਤ ਅਤੇ ਅਸੀਂ ਸਬਜ਼ੀਆਂ ਵਗੈਰਾ ਪੈਦਾ ਕਰਦੇ ਹਾਂ ਅਤੇ ਆਪ ਆਪਣੇ ਹੱਥੀ ਖੇਤੀਬਾੜੀ ਕਰਦੇ ਹਾਂ